ਕਟਿੰਗ ਜਾਂ ਬੀਜਾ ਤੋਂ ਹੋਰ ਅੱਗੇ ਪ੍ਰਸਾਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਪਿਉਂਦ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਪਿਉਂਦ ਚਾੜ੍ਹਨਾ ਜਿਵੇਂ ਗੁਲਾਬ ਤੋਂ ਹੋਰ ਕਲਮਾਂ ਕੱਟ ਕੇ ਅਸੀਂ ਹੋਰ ਗੁਲਾਬ ਦੇ ਪੌਦੇ ਪੈਦਾ ਕਰ ਸਕਦੇ ਹਾਂ ਐਵੇਂ ਹੀ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰਾਂ ਦੀਆਂ ਕਲਮਾਂ ਲਗਾ ਕੇ ਹੋਰ ਅੰਗੂਰਾਂ ਦੇ ਪੌਦੇ ਵਧਾ ਸਕਦੇ ਹਾਂ ਐਵੇਂ ਹੀ ਜਿਵੇਂ ਥੋੜ੍ਹੇ ਬੀਜਾਂ ਤੋਂ ਪਨੀਰੀ ਪੈਦਾ ਕਰਕੇ ਹੋਰ ਜ਼ਿਆਦਾ ਪਨੀਰੀ ਲ ਝੋਨੇ ਦੀ ਅਸੀਂ ਲਗਾ ਕੇ ਝੋਨੇ ਦੀ ਫਸਲ ਕੀਲਿਆਂ ਦੇ ਵਿੱਚ ਲਗਾ ਦਿੰਦੇ ਹਾਂ ਇਵੇਂ ਹੀ ਜਿਵੇਂ ਥੋੜ੍ਹੇ ਬੀਜ ਤੋਂ ਅਸੀਂ ਅੱਗੇ ਹੋਰ ਕਣਕ ਪੈਦਾ ਕਰਕੇ ਹੋਰ ਉਸੇ ਕਣਕ ਤੋਂ ਹੋਰ ਅੱਗੇ ਕੇਦਾ ਕਣਕ ਪੈਦਾ ਕਰਕੇ ਵਧਾ ਪੈਦਾਵਾਰ ਵਧਾ ਸਕਦੇ ਹਾਂ